ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਕਈ ਚੀਜ਼ਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਵੇਂ ਮੋ ਓਡੋਮੋਸ ਅਤੇ ਮੱਛਰਾਂ ਮਾਰਨ ਵਾਲਾ ਕੋਇਲਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਕਰਕੇ ਮੱਛਰ ਭੱਜਦੇ ਹੈ ਅਤੇ ਉਹ ਸਾਡੇ ਨੇੜੇ ਨਹੀਂ ਆਉਂਦੇ ਅਤੇ ਸਾਡੇ ਆਪਣੇ ਸਾਨੂੰ ਆਪਣੇ ਘਰ ਦੇ ਵਿੱਚ ਕਿਤੇ ਵੀ ਗੰਦਾ ਪਾਣੀ ਖੜ੍ਹਨ ਨਹੀਂ ਦੇਣਾ ਚਾਹੀਦਾ ਇਸ ਕਰਕੇ ਵੀ ਮੱਛਰ ਪੈਦਾ ਹੋ ਜਾਂਦੇ ਹੈ ਸਾਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ ਜੇ ਅਸੀਂ ਸਫਾਈ ਨਾ ਰੱਖੀਏ ਤਾਂ ਉਹਦੇ ਉੱਪਰ ਮੱਛਰ ਘੁੰਮਦੇ ਹੈ ਅਤੇ ਉਹੀ ਸਾਡੇ ਬਿਮਾਰ ਹੋਣ ਦਾ ਕਾਰਨ ਬਣਦਾ ਹੈ ਸਾਨੂੰ ਸਬਜ਼ੀਆਂ ਫਲਾਂ ਨੂੰ ਧੋ ਕੇ ਖਾਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਹੈ ਸਾਨੂੰ ਤਾਜ਼ੇ ਖਾਣੇ ਦਾ ਪ੍ਰਯੋਗ ਕਰਨਾ ਚਾਹੀਦਾ ਕੋਈ ਵੀ ਮਤਲਬ ਬਾਸੀ ਖਾਣਾ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਗੰਦਗੀ ਹੋਵੇ ਸਾਨੂੰ ਸਾਫ ਸੁਥਰਾ ਖਾਣਾ ਖਾੲ ਖਾਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਮੱਛਰਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਇਹ ਮੱਛਰ ਬੱਚਿਆਂ 'ਤੇ ਜ਼ਿਆਦਾ ਜਲਦੀ ਹਾਵੀ ਹੁੰਦੇ ਹਨ ਜਿਸ ਕਰਕੇ ਫਿਰ ਡੇਂਗੂ ਵਨ ਮਲੇਰੀਆ ਵਰਗੇ ਬਿਮਾਰੀਆਂ ਹੁੰਦੀਆਂ ਹਨ